ਮੈਂ ਬੂਸ਼ਾ ਖਾਤੂਨ ਮੈਂ ਇੱਕ ਵਾਰ ਪੀਜ਼ਾ ਮੰਗਾਇਆ ਸੀ ਅਤੇ ਉਹ ਸਹੀ ਸਮੇਂ 'ਤੇ ਮੇਰੇ ਘਰ ਡਿਲੀਵਰ ਹੋ ਗਿਆ ਸੀ ਉਹ ਦੇਖਣ ਵਿੱਚ ਵੀ ਠੀਕ ਸੀ ਅਤੇ ਖਾਣ ਵਿੱਚ ਵੀ ਬਹੁਤ ਸਵਾਦਿਸ਼ਟ ਸੀ ਜਦ ਮੈਂ ਦੂਜੀ ਵਾਰ ਪੀਜ਼ਾ ਮੰਗਾਇਆ ਤਾਂ ਉਹ ਮੇਰੇ ਘਰ ਲੇਟ ਡਿਲੀਵਰ ਹੋਇਆ ਜਿਸ ਕਰਕੇ ਉਹ ਠੰਡਾ ਹੋ ਗਿਆ ਸੀ ਅਤੇ ਉਹ ਖਾਣ ਵਿੱਚ ਵੀ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਇੱਕ ਵਾਰੀ ਮੈਂ ਜਦੋਂ ਢਾਬੇ ਤੋਂ ਖਾਣਾ ਮੰਗਾਇਆ ਮੰਗਾਇਆ ਸੀ ਜਿਸ ਵਿੱਚ ਸ਼ਾਹੀ ਪਨੀਰ ਅਤੇ ਦਾਲ ਮੱਖਣੀ ਸੀ ਸ਼ਾਹੀ ਪਨੀਰ ਤਾਂ ਬਿਲ ਬਿਲਕੁਲ ਚੰਗਾ ਸੀ ਪਰ ਦਾਲ ਮੱਖਣੀ ਵਿੱਚ ਨੂਨ ਜ਼ਿਆਦਾ ਪੈ ਗਿਆ ਸੀ ਜਦੋਂ ਮੈਂ ਔਡਰ ਕੀਤਾ ਸੀ ਤਾਂ ਮੈਂ ਇਹੀ ਕਿਹਾ ਕਿ ਮੈਨੂੰ ਤੁਸੀਂ ਜੋ ਵੀ ਸਬਜ਼ੀ ਦਾਲ ਭੇਜੋਗੇ ਉਹ ਜ਼ਿਆਦਾ ਮਾਸ਼ਾਲਾਹ ਮਸਾਲੇਦਾਰ ਨਾ ਹੋਵੇ ਉਹਨਾਂ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਨਾ ਹੋਵੇ ਇਹ ਮੈਂ ਇਸ ਲਈ ਕਿਹਾ ਸੀ ਕਿਉਂਕਿ ਮੇਰੇ ਦਾਦਾ ਜੀ ਨੇ ਵੀ ਇਹ ਖਾਣਾ ਖਾਪੋ ਇਹ ਖਾਣਾ ਖਾਣਾ ਸੀ ਮੇਰੇ ਦਾਦਾ ਜੀ ਨੂੰ ਬਲੱਡ ਪ੍ਰੈਸ਼ਰ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਇਹ ਸਭ ਖਾਣਾ ਖਾ ਕੇ ਇਹ ਖਾਣਾ ਉਹ ਨਹੀਂ ਖਾ ਸਕਦੇ ਜਿਸ ਕਰਕੇ ਮੇਰਾ ਇਹ ਮੰਗਾਇਆ ਹੋਇਆ ਖਾਣਾ ਬੇਕਾਰ ਹੋ ਗਿਆ ਇਸ ਵਿੱਚ ਮਿੱਠਾ ਵੀ ਮੰਗਾਇਆ ਸੀ ਜੋ ਕਿ ਬਹੁਤ ਜ਼ਿਆਦਾ ਹੀ ਮਿੱਠਾ ਸੀ ਅਤੇ ਉਹ ਮੇਰੇ ਦਾਦਾ ਜੀ ਨਹੀਂ ਖਾ ਸਕਦੇ ਇਸ ਲਈ ਮੈਂ ਇਹੀ ਸੁਝਾਓ ਦੇਣਾ ਚਾਹੁੰਦੀ ਹਾਂ ਕਿ ਜੋ ਵੀ ਔਡਰ ਕੀਤਾ ਹੋਇਆ ਹੁੰਦਾ ਹੈ ਔਡਰ ਉਹੀ ਭੇਜਣਾ ਚਾਹੀਦਾ ਹੈ ਅਤੇ ਕਿਸੀ ਦਾ ਨੁਕਸਾਨ ਨਾ ਹੋਵੇ ਇਹ ਡਲੇਵਰ ਬੋਆਏ ਨੇ ਲੇਟ ਖਾਣਾ ਭੇਜਿਆ ਜਿਸ ਕਰਕੇ ਖਾਣਾ ਦਾ ਸਵਾਦ ਵੀ ਚੰਗਾ ਨਹੀਂ ਸੀ